ਸਾਡੇ ਰੂਪਨਗਰ ਜ਼ਿਲ੍ਹੇ ਦੇ ਵਿੱਚ ਹੈ ਨਾ ਬਹੁਤ ਸਾਰੇ ਅਖ਼ਬਾਰ ਆਉਂਦੇ ਆ ਪਰ ਜਿਨ੍ਹਾਂ ਵਿੱਚੋਂ ਮਸ਼ਹੂਰ ਅਖ਼ਬਾਰ ਹੋ ਗਏ ਜਿੱਦਾਂ ਕਿ ਅਜੀਤ ਹੋ ਗਿਆ ਹੈ ਨਾ ਮੈਗਜ਼ੀਨਸਜ਼ ਹੋ ਗਏ ਜਾਂ ਕੇਸਰੀ ਅਖ਼ਬਾਰ ਇਨ੍ਹਾਂ ਨੂੰ ਲੋਕ ਪੜ੍ਹਨਾ ਜ਼ਿਆਦਾ ਪਸੰਦ ਕਰਦੇ ਹਨ ਅਤੇ ਇਨ੍ਹਾਂ ਵਿੱਚ ਬਹੁਤ ਸਾਰੀ ਸਾਨੂੰ ਮਹੱਤਵਪਰਨ ਜਾਣਕਾਰੀ ਮਿਲ ਜਾਂਦੀ ਹੈ ਅਤੇ ਬਹੁਤ ਵਧੀਆ ਤਰੀਕੇ ਨਾਲ ਹੈ ਨਾ ਇਹਦੇ ਵਿੱਚ ਨਿਊਜ਼ ਨੂੰ ਦੱਸਿਆ ਜਾਂਦਾ ਹੈ ਅਤੇ ਸਾਡੇ ਹੈ ਨਾ ਜੇ ਜੇ ਸਾਡੇ ਪਿੰਡਾਂ ਦੇ ਵਿੱਚ ਅਗਰ ਕੋਈ ਵੀ ਚੀਜ਼ ਬਾਰੇ ਦੱਸਣਾ ਹੋਵੇ ਹੈ ਨਾ ਅਤੇ ਕਿਸੇ ਲੋਕਾਂ ਨੂੰ ਜਾਗਰੂਕ ਕਰਨਾ ਹੋਵੇ ਤਾਂ ਹੈ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਸਮੈਂਟ ਕਰਵਾਈ ਜਾਂਦੀ ਹੈ ਇੱਕ ਜਗ੍ਹਾ ਕਰਵਾ ਕੇ ਸਾਰੇ ਪਿੰਡ ਨੂੰ ਜਾਗਰੂਕ ਕਰ ਦਿੱਤਾ ਜਾਂਦਾ ਇਹਦੇ ਨਾਲ